ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਦੀ ਬਿਹਤਰੀ ਲਈ ਪੰਜਾਬ ਸਰਕਾਰ ਵੱਲੋਂ ਕਈ ਚੀਜ਼ਾਂ 'ਤੇ ਟੈਕਸਾਂ ਰਾਹੀਂ ਫੰਡ ਇਕੱਤਰਤ ਕਰਕੇ ਸਿੱਖਿਆ ਖੇਤਰ ਨੂੰ ਫੰਡ ਦਿੱਤੇ ਜਾਂਦੇ ਹਨ ਜਿਸ ਨਾਲ਼ ਸਕੂਲ ਸਿੱਖਿਆ ਦੀ ਮਿਆਰ ਉੱਚਾ ਉੱਠਿਆ ਹੈ